ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਫੈਸ਼ਨ ਬੁਟੀਕ ਤੋਂ ਬੋਲਦੇ ਹੋ ਤੁਸੀਂ ਜੀ ਮੈਮ ਮੈਂ ਨਾ ਇਕ ਸੂਟ ਸਟਿੱਚ ਕਰਵਾਣਾ ਸੀ ਮੈਮ ਪਲਾਜ਼ੋ ਸੂਟ ਹੈ ਜੀ ਉਹ ਸਟਿੱਚ ਨਹੀ ਸਟ੍ਰੇਟ ਪਲਾਜ਼ੋ ਬਣਵਾਨਾ ਵਾ ਤੁਹਾਡੇ ਬਾਰੇ ਤੁਸੀਂ ਦੱਸ ਸਕਦੇ ਹੋ ਕਿ ਮਤਲਬ ਸਿ ਸਿਲਕ ਹੈ ਜੀ ਸਿਲਕ ਹੈ ਜੀ ਜੀ ਨਹੀਂ ਨਹੀਂ ਬੈਲਟ ਲਗਵਾਉਣੀ ਹੈ ਹਾਂਜੀ ਦੋਨੋਂ ਸਾਈਡ ਹਾਂਜੀ ਅੱਠ ਪੌਚਾ ਰੱਖਣਾ ਹੈ ਅਤੇ ਉਹਦੇ 'ਚ ਬਟਨ ਵੀ ਲਗਾਣੇ ਆਂ ਹਾਂਜੀ ਸ਼ਰਟ ਦੇ ਗਲੇ ਸ਼ੋਟ ਈ ਰੱਖਣੇ ਆ ਬਹੁਤੇ ਉਹ ਡੀਪ ਨੀ ਰੱਖਣੇ ਅਤੇ ਇਨਰ ਪਾਈਪਿੰਗ ਵਗੈਰਾ ਲਗਾਣੀ ਹੈਗੀ ਉਹਨਾਂ ਨੂੰ ਤੁਹਾਡੀ ਡਿਜ਼ਾਇਨਿੰਗ ਹੋ ਜੇ ਪਾਰਟੀ ਵੇਅਰ ਸੂਟ ਹੈ ਜੀ ਨਹੀਂ ਨਹੀਂ ਜੀ ਸਿੰਪਲੀ ਕਰਨਾ ਏ ਸਟਿੱਚ ਕਰਨਾ ਏ ਬਸ ਤੁਸੀਂ ਉਹ ਪਾਈਪਿੰਗ ਵਗੈਰਾ ਲਗਾ ਦੇਣੀ ਹੈ ਅਤੇ ਸਟਿਚਿੰਗ ਬਾਰੇ ਤੁਸੀਂ ਕੁਛ ਦੱਸ ਦੋ ਜੇ ਤੁਸੀਂ ਪ੍ਰੋਵਾਈਡ ਕਰ ਦੋ ਤਾਂ ਬੈਸਟ ਹੈ

ਠੀਕ ਹੈ ਜੀ ਅਸੀਂ ਕੋਈ ਜਨਵਰੀ ਦੀ ਪੰਜ ਸੱਤ ਤਰੀਕ ਤੱਕ ਹੋਰ ਵੀ ਸੂਟ ਹੋਰ ਵੀ ਸੂਟ ਡਿਜ਼ਾਈਨ ਕਰਵਾਉਣੇ ਆ ਮੈਮ ਪਰ ਤੁਸੀਂ ਪਹਿਲਾਂ ਇੱਕ ਤਿਆਰ ਕਰ ਦੋ ਠੀਕ ਹੈ ਜੀ ਠੀਕ ਹੈ ਜੀ ਓਕੇ ਓਕੇ ਥੈਂਕ ਯੂ